ਮੈਨੂੰ ਖਾਣਾ ਬਣਾਉਣ ਦਾ ਬਚਪਨ ਤੋਂ ਹੀ ਕਾਫੀ ਸ਼ੌਕ ਹੈ ਅਤੇ ਮੈਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਾਫੀ ਸਾਰੇ ਨਵੇਂ ਨਵੇਂ ਭੋਜਨ ਬਣਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਅਤੇ ਕਈ ਵਾਰੀ ਤਾਂ ਮੈਂ ਉਹਨਾਂ ਨੂੰ ਬਣਾਉਣ ਵਿੱਚ ਸਫ਼ਲ ਹੋ ਜਾਂਦੀ ਹਾਂ ਅਤੇ ਉਹ ਕਾਫੀ ਸਵਾਦਿਸ਼ਟ ਬਣਦੇ ਆ ਪਰ ਕਈ ਵਾਰੀ ਮੇਰੇ ਨਾਲ ਇੱਦਾਂ ਵੀ ਹੋ ਜਾਂਦਾ ਹੈ ਕਿ ਉਹ ਭੋਜਨ ਬਿਲਕੁਲ ਹੀ ਖ਼ਰਾਬ ਹੋ ਜਾਂਦਾ ਅਤੇ ਉਹ ਖਾਣ ਲਾਇਕ ਵੀ ਨਹੀਂ ਰਹਿੰਦਾ ਅਤੇ ਮੈਂ ਆਪਣੇ ਜੀਵਨ ਵਿੱਚ ਕਾਫੀ ਸਾਰੇ ਭੋਜਨ ਟਰਾਈ ਕਰਦੀ ਰਹਿੰਦੀ ਹਾਂ ਪਰ ਜਿਹੜਾ ਮੈਂ ਆਪਣੇ ਜੀਵਨ ਦਾ ਪਹਿਲਾ ਭੋਜਨ ਬਣਾਇਆ ਸੀ ਉਹ ਇੱਕ ਚਾਈਨੀਜ਼ ਪਕਵਾਨ ਹੈ ਜਿਸਦਾ ਨਾਮ ਮਨਚੂਰੀਅਨ ਹੈ ਅਤੇ ਜਿਹੜਾ ਮਨਚੂਰੀਅਨ ਹੈ ਉਹ ਇੱਕ ਕਾਫੀ ਮਸ਼ਹੂਰ ਚਾਈਨੀਜ਼ ਪਕਵਾਨ ਹੈ ਅਤੇ ਇਹਦੀ ਮਨਚੂਰੀਅਨ ਬਣਾਉਣ ਦੀ ਜਿਹੜੀ ਰੈਸਪੀ ਸੀ ਉਹ ਮੈਂ ਇੱਕ ਯੂਟਿਊਬ ਚੈਨਲ ਤੋਂ ਬਣਾਉਣੀ ਸਿੱਖੀ ਸੀ ਅਤੇ ਜਿਹੜਾ ਸ਼ੈਫ ਯੂਟਿਊਬ ਚੈਨਲ 'ਤੇ ਦੱਸ ਰਿਹਾ ਸੀ ਰੈਸਪੀ ਨੂੰ ਉਸਨੇ ਕਾਫੀ ਅੱਛੀ ਤਰ੍ਹਾਂ ਸਮਝਾਇਆ ਸਾਨੂੰ ਕਿ ਸਟੈਪ ਬਾਏ ਸਟੈਪ ਅਸੀਂ ਕਿੱਦਾਂ ਸਬਜ਼ੀਆਂ ਕੱਟਣੀਆਂ ਸਨ ਅਤੇ ਉਹਨਾਂ ਨੂੰ ਕਿੰਨੀ ਦੇਰ ਫਰਾਈ ਕਰਨਾ ਜਾਂ ਬੋਇਲ ਕਰਨਾ ਹੈ ਅਤੇ ਮਨਚੂਰੀਅਨ ਬੋਲਸ ਜਿਹੜੇ ਹੁੰਦੇ ਉਹਨਾਂ ਨੂੰ ਕਿੰਨੀ ਦੇਰ ਫਰਾਈ ਕਰਨਾ ਹੈ ਟੈਂਪਰੇਚਰ ਕਿੰਨਾ ਰੱਖਣਾ ਹੈ ਅਤੇ ਕਿੰਨੀ ਦੇਰ ਤੱਕ ਉਹਦੀ ਗਰੇਵੀ ਬਣਾਉਣੀ ਹੈ ਅਤੇ ਮੈਂ ਜਿੱਦਾਂ ਹੀ ਰੈਸਪੀ ਸ਼ੈਫ ਦੱਸ ਰਿਹਾ ਸੀ ਉੱਦਾਂ ਹੀ ਉਹਨੂੰ ਅਪਣਾਉਂਦੀ ਗਈ ਅਤੇ ਮਨਚੂਰੀਅਨ ਦੀ ਰੈਸਪੀ ਬਣਾਉਣ 'ਚ ਮੈਂ ਸਫ਼ਲ ਰੈਗੀ ਹੋ ਗਈ ਅਤੇ ਉਹ ਜਦੋਂ ਖਾਧਾ ਪਰਿਵਾਰ ਜਿਨ੍ਹਾਂ ਨੇ ਅਸੀਂ ਸਾਰਿਆਂ ਨੇ ਰਲ ਕੇ ਅਤੇ ਸਾਨੂੰ ਕਾਫੀ ਵਧੀਆ ਰੈਸਪੀ ਲੱਗੀ ਅਤੇ ਉਹਦਾ ਟੇਸਟ ਖਾਣ ਵਿੱਚ ਕਾਫੀ ਅੱਛਾ ਸੀ ਅਤੇ ਸਾਰਿਆਂ ਨੂੰ ਬਹੁਤ ਪਸੰਦ ਆਇਆ